ਅੱਜ ਕੱਲ੍ਹ ਖਿਡਾਰੀ ਆਪਣਾ ਜੋਸ਼ ਫੁਰਤੀਲਾਪਣ ਆਦਿ ਆਪਣੇ ਆਦਿ ਆਪਣੇ ਸਰੀਰ ਵਿੱਚ ਲਿਆਉਣ ਲਈ ਕੁਝ ਨਸ਼ਿਆਂ ਦੀ ਡੋਜ਼ ਲੈਂਦੇ ਹਨ ਜਿਸ ਕਾਰਨ ਕਿ ਜਿਸ ਕਾਰਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ 'ਚ ਜੋਸ਼ ਆਊਗਾ ਅਤੇ ਅਸੀਂ ਬਹੁਤ ਜਲਦੀ ਬਹੁਤ ਜਲਦੀ ਨਾਲ ਖੇਡ ਸਕਦੇ ਹਾਂ ਪਰ ਇਹ ਪਰ ਇਹ ਬਿਲਕੁਲ ਗਲਤ ਹੈ ਇਸ ਨਾਲ ਇਸ ਨਾਲ ਸਰੀਰ ਦਾ ਨੁਕਸਾਨ ਹੁੰਦਾ ਹੈ ਅਤੇ ਕੁਛ ਕੁ ਖਿਡਾਰੀਆਂ ਦੀ ਤਾਂ ਇਸ ਉਪਰੰਤ ਮੌਤ ਵੀ ਹੋ ਜਾਂਦੀ ਹੈ ਜਿਸ ਨਾਲ ਕਿ ਉਹ ਆਪਣੀ ਜਾਨ ਗਵਾ ਲੈਂਦਾ ਹੈ ਇਸਦੀ ਬਜਾਏ ਸਾਨੂੰ ਚੰਗੀ ਡਾਇਟ ਲੈਣੀ ਚਾਹੀਦੀ ਹੈ ਖੇਡਾਂ ਵਿੱਚ ਆਪਣਾ ਜੋਸ਼ ਫੁਰਤੀਲਾਪਣ ਦਿਖਾਉਣ ਲਈ ਅਤੇ ਆਪਣੀ ਜਿੱਤ ਹਾਸਿਲ ਕਰਨ ਲਈ ਸਾਨੂੰ ਅਤੇ ਦੁੱਧ ਕੁਝ ਕੁਛ ਇੱਦਾਂ ਦੇ ਡਾਈਟ ਲੈਣੀ ਚਾਹੀਦੀ ਜਿਸ ਵਿੱਚ ਕਿ ਦੁੱਧ ਦਹੀਂ ਪਨੀਰ ਸੈਲਡ ਫਲ ਫਰੂਟ ਆਦਿ ਖਾਣੇ ਚਾਹੀਦੇ ਹਨ ਜਿਸ ਨਾਲ ਕਿ ਸਾਡਾ ਸਰੀਰ ਵੀ ਹਮੇਸ਼ਾ ਲਈ ਤੰਦਰੁਸਤ ਰਹਿੰਦਾ ਹੈ ਅਤੇ ਇਸਦੀ ਬਜਾਏ ਸਾਨੂੰ ਨਕਲੀ ਤਰੀਕੇ ਦਾ ਕੋਈ ਵੀ ਇਸਤੇਮਾਲ ਕੋਈ ਵੀ ਇਸਤੇਮਾਲ ਜਿਵੇਂ ਕਿ ਡੋਸ ਵਗੇ ਨਸ਼ੇ ਦੀ ਡੋਜ਼ ਵਗੈਰਾ ਨਹੀਂ ਲੈਣੀ ਚਾਹੀਦੀ ਇਸ ਬਲਕਿ ਸਾਨੂੰ ਚੰਗੀ ਡਾਇਟ ਲੈਣੀ ਚਾਹੀਦੀ ਹੈ ਜਿਸ ਵਿੱਚ ਕਿ ਦੁੱਧ ਦਹੀਂ ਪਨੀਰ ਦੇਸੀ ਘਿਉ ਆਦਿ ਸਾਨੂੰ ਵਰਤੋਂ ਵਿੱਚ ਲੈਣਾ ਚਾਹੀਦਾ ਹੈ